ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੈਗਾ ਮਤਲਬ ਕਿ ਆਪਣੇ ਸੈਮਸੰਗ ਨੋਕੀਆ ਸੋਨੀ ਕੰਪਨੀ ਦਾ ਸੈਮਸੰਗ ਕੰਪਨੀ ਦਾ ਹਾਂਜੀ ਅਤੇ ਸੈਮਸੰਗ ਵਾਲਾ ਜੀ ਦਸ ਹਜ਼ਾਰ ਤੱਕ ਵੀ ਹੈ ਪੰਦਰਾਂ ਤਾ ਪੰਦਰਾਂ ਹਜ਼ਾਰ ਤੱਕ ਵੀ ਹੈ ਅਤੇ ਨੋਕੀਆ ਦਾ ਜਿਵੇਂ ਬਾਰਾਂ ਹਜ਼ਾਰ ਤੱਕ ਹੋ ਗਿਆ ਇਸ ਤਰ੍ਹਾਂ ਚੋਦਾਂ ਹਜ਼ਾਰ ਤੱਕ ਵੀ ਹੈ ਹਾਂਜੀ ਹਾਂਜੀ ਹਾਂਜੀ ਹੋ ਜੇਗਾ ਜੀ ਹਾਂਜੀ ਹਾਂਜੀ ਹਾਂਜੀ ਬਹੁਤ ਵਧੀਆ ਹੈ ਕੈਮਰਾ ਕੁਆਲਿਟੀ ਬਹੁਤ ਵਧੀਆ ਹੈ ਨਹੀਂ ਜੀ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਸਾਲ ਦੀ ਗਰੰਟੀ ਇੱਕ ਸਾਲ ਦੀ ਗਰੰਟੀ ਹੈ ਇਹਦੀ ਹਾਂਜੀ ਹਾਂਜੀ ਹਾਂਜੀ ਕੰਪਨੀ ਦਾ ਹੈ ਨਾ ਫਿਰ ਕੰਪਨੀ ਆਪਣੀ ਤਰਫ ਤੋਂ ਇੱਕ ਸਾਲ ਦੀ ਗਰੰਟੀ ਦਿੰਦੀ ਹੈ ਹਾਂਜੀ ਬਿਲਕੁਲ ਦੇਵਾਂਗੇ ਜੀ ਹਾਂਜੀ ਹਾਂਜੀ ਜ਼ਰੂਰ ਜੀ ਦੇਵਾਂਗੇ ਹਾਂਜੀ ਓਕੇ ਔਨਲਾਈਨ ਘਰ ਔਨਲਾਈਨ ਭੇਜੀਏ ਹਾਂਜੀ ਠੀਕ ਹੈ ਓਕੇ ਪੇਮੈਂਟ ਪੇਮੈਂਟ ਕਦੋਂ ਕਰੋਗੇ ਹਾਂਜੀ ਠੀਕ ਹੈ ਜੀ ਓਕੇ ਹਾਂਜੀ ਜੀ ਹਾਂਜੀ ਚਲੋ ਓਕੇ ਹਾਂਜੀ ਠੀਕ ਹਾਂਜੀ